ਮੈਂ ਜੇ ਆਪਦੇ ਪਿੰਡ ਬਾਰੇ ਗੱਲ ਕਰਾਂ ਤਾਂ ਮੈਨੂੰ ਮੈਂ ਕਹਾਂਗੀ ਕਿ ਸਾਡਾ ਪਿੰਡ ਪਿੰਡਾਂ ਵਿੱਚੋਂ ਪਿੰਡ ਇੱਕੋ ਹੀ ਪਿੰਡ ਹੈ ਰਾਮਪੁਰਾ ਇਹ ਪਿੰਡ ਮੈਨੂੰ ਇੰਨਾ ਸੋਹਣਾ ਲੱਗਦਾ ਹੈ ਕਿ ਮੈਂ ਕਿਸੇ ਵੀ ਵੱਡੇ ਸ਼ਹਿਰ ਦੀ ਤੁਲਨਾ ਜੇ ਇਹਦੇ ਨਾਲ ਕਰਾਂ ਕਿਸੇ ਵੱਡੇ ਹਿਲ ਸਟੇਸ਼ਨ ਦੀ ਤੁਲਨਾ ਮੈਂ ਕਰਾਂ ਤਾਂ ਉੱਥੇ ਵੀ ਮੈਂ ਸ਼ਾਇਦ ਦੋ ਜਾਂ ਤਿੰਨ ਦਿਨ ਹੀ ਰਹਿ ਸਕਾਂਗੀ ਪਰ ਮੈਂ ਆਪਦੇ ਇਸ ਪਿੰਡ ਵਿੱਚ ਪਿਛਲੇ ਤੀਹ ਵਰ੍ਹਿਆਂ ਤੋਂ ਰਹਿ ਰਹੀ ਹਾਂ ਮੇਰੇ ਪਿੰਡ ਦੀ ਆਬੋ ਹਵਾ ਇੰਨੀ ਸਾਫ ਸੁਥਰੀ ਅਤੇ ਅੱਛੀ ਹੈ ਕਿ ਇੱਥੇ ਆਉਣ ਤੋਂ ਬਾਅਦ ਐਂਈ ਲੱਗਦਾ ਹੈ ਕਿ ਸਾਰਾ ਦਿਲ ਅਤੇ ਦਿਮਾਗ ਬਿਲਕੁਲ ਸਾਫ ਸੁਥਰਾ ਅਤੇ ਫਰੈਸ਼ ਹੋ ਗਿਆ ਹੈ ਸਾਡੇ ਪਿੰਡ ਦੇ ਜ਼ਿਆਦਾਤਰ ਲੋਕ ਖੇਤੀ ਦੇ ਕਿੱਤੇ ਨਾਲ ਜੁੜੇ ਹਨ ਉਹ ਬਹੁਤ ਹੀ ਸਿੱਧੇ ਸਾਧੇ ਅਤੇ ਭੋਲੇ ਲੋਕ ਹਨ ਕੋਈ ਵੱਲ ਛੱਲ ਉਹਨਾਂ ਦੇ ਵਿਵਹਾਰ ਵਿੱਚ ਨਜ਼ਰ ਨਹੀਂ ਆਉਂਦਾ ਬੜੇ ਹੀ ਰੱਬ ਤੋਂ ਡਰਨ ਵਾਲੇ ਅਤੇ ਧਾਰਮਿਕ ਪ੍ਰਵਿਰਤੀ ਦੇ ਲੋਕ ਰਹਿੰਦੇ ਹਨ ਸਾਡੇ ਪਿੰਡ ਦੇ ਆਸ ਪਾਸ ਦੇ ਪਿੰਡ ਵੀ ਸਾਡੇ ਪਿੰਡ ਦੀ ਗੱਲ ਕਰਕੇ ਮਾਣ ਮਹਿਸੂਸ ਕਰਦੇ ਹਨ ਸਾਡੇ ਪਿੰਡ ਵਿੱਚ ਕਈ ਤਰ੍ਹਾਂ ਦੇ ਕਿੱਤੇ ਹੋਰ ਵੀ ਹੈਗੇ ਹਨ ਜਿਹਨਾਂ ਦੇ ਵਿੱਚ ਲੋਕ ਰੁੱਝੇ ਰਹਿੰਦੇ ਹਨ ਸਾਡੇ ਪਿੰਡ ਦੀ ਪੜ੍ਹਾਈ ਦਾ ਅਦਾਰਾ ਵੀ ਬਹੁਤ ਅੱਛਾ ਹੈ ਇੱਥੇ ਦੇ ਵਿਦਿਆਰਥੀ ਭਾਵੇਂ ਉਹ ਲੜਕੀ ਹੋਵੇ ਭਾਵੇਂ ਉਹ ਲੜਕਾ ਹੋਵੇ ਉਹਨਾਂ ਨੇ ਜੀਅ ਜਾਨ ਲਗਾ ਕੇ ਆਪਦੀ ਪੜ੍ਹਾਈ ਨੂੰ ਪੂਰਾ ਕਰਨਾ ਹੁੰਦਾ ਹੈ ਅਤੇ ਆਸ ਪਾਸ ਦੇ ਜਿੰਨੇ ਵੀ ਪ੍ਰਦੇਸ਼ ਨੇ ਉਹਨਾਂ ਦੇ ਵਿੱਚ ਸਾਡੇ ਪਿੰਡ ਦੇ ਬੱਚਿਆਂ ਦੀ ਪੜ੍ਹਾਈ ਦਾ ਡੰਕਾ ਬੋਲਦਾ ਹੈ ਇੱਥੋਂ ਦੇ ਨਾ ਸਿਰਫ ਪੜ੍ਹਾਈ ਅਤੇ ਕਿੱਤਿਆਂ ਦੀ ਗੱਲ ਕੀਤੀ ਜਾਵੇ ਬਲਕਿ ਇੱਥੇ ਦੀਆਂ ਕਈ ਪ੍ਰਸਿੱਧ ਮਿਠਾਈਆਂ ਵੀ ਨੇ ਜਿਹੜੀਆਂ ਕਿ ਆਸ ਪਾਸ ਦੇ ਪਿੰਡਾਂ ਦੇ ਵਿੱਚ ਹੋਰ ਤਾਂ ਹੋਰ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਵੀ ਉਹਨਾਂ ਦੀ ਬਹੁਤ ਮੰਗ ਹੈ